ਭੈਣ ਧੀ ਅਤੇ ਦੋਸਤ ਦੀ ਜਿਹੜੀ ਸਿੱਖਿਆ ਦੇ ਸੰਬੰਧੀ ਹੈ ਹਰ ਇੱਕ ਪਰਸਨ ਨੂੰ ਸਿੱਖਿਆ ਦੇ ਸੰਬੰਧ ਵਿੱਚ ਜ਼ਰੂਰ ਐਜੂਕੇਟ ਹੋਣਾ ਚਾਹੀਦਾ ਹੈ ਕਿਉਂਕਿ ਐਜੂਕੇਟ ਪਰਸਨ ਹੀ ਆਪਣੇ ਪਰਿਵਾਰ ਨੂੰ ਅੱਗੇ ਤੋਰ ਸਕਦਾ ਹੈ ਜਿੱਥੋਂ ਤੱਕ ਕੋਸ਼ਿਸ਼ ਹੋਣੀ ਚਾਹੀਦੀ ਹੈ ਹਰ ਇੱਕ ਔਰਤ ਨੂੰ ਸਿੱਖਿਅਤ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਔਰਤਾਂ ਹੀ ਸਿੱਖਿਆ ਦੇ ਖੇਤਰ ਵਿੱਚ ਅੱਗੇ ਆ ਰਹੀਆਂ ਹਨ ਕਿਉਂਕਿ ਜੇਕਰ ਆਪਾਂ ਦੇਖੀਏ ਤਾਂ ਜਿੰਨੇ ਵੀ ਅਦਾਰੇ ਹਨ ਉਹਨਾਂ ਦੇ ਵਿੱਚ ਜ਼ਿਆਦਾ ਜੋ ਔਰਤਾਂ ਹਨ ਉਹ ਜੋਬ ਕਰਦੀਆਂ ਹਨ ਸਿੱਖਿਆ ਦੇ ਖੇਤਰ ਵਿੱਚ ਜੋ ਅਧਿਆਪਕ ਹਨ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਗਿਣਤੀ ਔਰਤਾਂ ਦੀ ਹੀ ਹੈ ਕਿਉਂਕਿ ਪੁਰਸ਼ ਪੁਰਸ਼ਾਂ ਦੇ ਵਿੱਚ ਜੋ ਸਿੱਖਿਆ ਗ੍ਰਹਿਣ ਕਰਨ ਦੀ ਪ੍ਰਵਿਰਤੀ ਹੈ ਉਹ ਘੱਟਦੀ ਜਾ ਰਹੀ ਹੈ ਅਤੇ ਔਰਤਾਂ ਦੀ ਜਿਹੜੀ ਗਿਣਤੀ ਹੈ ਉਹ ਵੱਧਦੀ ਜਾ ਰਹੀ ਅੱਜ ਕੱਲ੍ਹ ਜੋ ਰਿਸ਼ਤਿਆਂ ਦਾ ਜੋ ਵਿਆਹਾਂ ਦਾ ਕੰਮ ਹੈ ਉਸ ਸੰਬੰਧੀ ਵੀ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਹਰ ਇੱਕ ਵਿਅਕਤੀ ਇਹ ਪੁੱਛਦਾ ਹੈ ਕਿ ਬੱਚੀ ਕਿੰਨੀ ਪੜ੍ਹੀ ਲਿਖੀ ਹੈ ਜੇਕਰ ਬੱਚੀ ਐਜੂਕੇਟ ਹੋਵੇਗੀ ਤਾਂ ਹੀ ਆਪਣੇ ਪਰਿਵਾਰ ਨੂੰ ਅੱਗੇ ਲੈ ਜਾਣ ਵਿੱਚ ਪੁਰਸ਼ ਦੀ ਸਹਾਇਤਾ ਕਰ ਸਕਦੀ ਹੈ